ਦੋ ਮਈ ਦੋ ਹਜ਼ਾਰ ਪੰਜ ਸਤਾਈ ਅਗਸਤ ਦੋ ਹਜ਼ਾਰ ਸੱਤ ਪੰਜ ਅਕਤੂਬਰ ਦੋ ਹਜ਼ਾਰ ਪੰਦਰਾਂ ਛੇ ਅਪ੍ਰੈਲ ਉੱਨੀ ਸੌ ਛਪੰਜਾ ਚੌਵੀ ਅਕਤੂਬਰ ਉੱਨੀ ਸੌ ਬਵੰਜਾ